ਸਤਿ ਸ਼੍ਰੀ ਅਕਾਲ ਜੀ ਹਾਂਜੀ ਜੈਨ ਜੀ ਆਪਣੇ ਟਰਾਂਸਪੋਰਟ ਤੋਂ ਬੋਲਦੇ ਆ ਜੀ ਹੈਂਜੀ ਹਾਂ ਆਪਣੀ ਇੱਕ ਗੱਡੀ ਚਾਹੀਦੀ ਸੀ ਟੂਰਿਸਟ ਜਿਵੇਂ ਘੁੰਮਣ ਖਾਤਰ ਜੀ ਆਪਾਂ ਜੀ ਜੈਪੁਰ ਜਾਣਾ ਸੀਗਾ ਜੈਪੁਰ ਘੁੰਮਣ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫੈਮਲੀ ਜਾ ਰਹੀ ਹੈ ਨਾਲ ਰਿਸ਼ਤੇਦਾਰ ਵੀ ਹੈ ਜੀ ਆਪਣੇ ਫੈਮਲੀ ਆ ਸਾਰੀ ਫੈਮਲੀ ਆ ਜੀ ਆ ਆਪਾਂ ਨੂੰ ਤਕਰੀਬਨ ਜੀ ਬੱਤੀ ਸੀਟਾਂ ਤਾਂ ਹੋਵੇ ਹੀ ਹੋਵੇ ਜੀ ਉੱਚੀ ਬਸ ਜਿਹੜੀ ਵਧੀਆ ਏ ਸੀ ਵਾਲੀ ਹੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਨੂੰ ਮਤਲਬ ਜੀ ਏ ਸੀ ਬੱਸ ਚਾਹੀਦੀ ਆ ਹਾਂਜੀ ਹਾਂਜੀ ਆਪਾਂ ਨੂੰ ਜੀ ਕਿੰਨਾ ਕਿੰਨੇ ਕੁ ਕਿਲੋਮੀਟਰਾਂ ਦੇ ਹਿਸਾਬ ਨਾਲ ਲਓਗੇ ਜੀ ਕਿ ਦਿਹਾੜੀ ਦੇ ਹਿਸਾਬ ਨਾਲ ਦਿਨ ਤਾ ਤਕਰੀਬਨ ਜੀ ਆਪਾਂ ਨੂੰ ਪੰਦਰਾਂ ਦਿਨ ਲੱਗ ਹੀ ਜਾਣਗੇ ਜੀ ਆਰਾਮ ਨਾਲ

ਹਾਂ ਹਾਂ ਹਾਂ ਉੱਧਰ ਘੁੰਮਣ ਜਾਣਾ ਹਾਂਜੀ ਹਾਂਜੀ ਤੁਹਾਡੇ ਜੀ ਮੰਨ ਲਓ ਜੀ ਇਹਨਾਂ ਨੂੰ ਪਤਾ ਹੋਊਗਾ ਜੀ ਸਾਨੂੰ ਜੀ ਡਰਾਈਵਰ ਵਧੀਆ ਭੇਜਿਓ ਜੀ ਨਾਲ ਸਾਰੀ ਨੌਲੇਜ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੇਦੇ ਆਪਾਂ ਨੂੰ ਜੀ ਦੱਸ ਦਿਓ ਜੀ ਕਿੰਨਾ ਕਿਹਦੇ ਹਿਸਾਬ ਨਾਲ ਜੀ ਆਪਾਂ ਨੂੰ ਕਿਵੇਂ ਕਰੋਂਗੇ ਜੀ ਤੁਸੀਂ ਇੱਕ ਤਾਂ ਹੁੰਦਾ ਜੀ ਮੰਨ ਲਓ ਕਿਲੋਮੀਟਰ ਦਾ ਹਿਸਾਬ ਲਓਗੇ ਤੇ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਂ ਆਪਾਂ ਜੀ ਤੁਹਾਡੀ ਟਰਾਂਸਪੋਟ 'ਚੋਂ ਹੀ ਲਿਆ ਸੀ ਜੀ ਤਾਂ ਕਰਕੇ ਤਾਂ ਹੀ ਤੁਹਾਨੂੰ ਫੋਨ ਕੀਤਾ ਸੀਗਾ ਜੀ ਕਹਿੰਦੇ ਬੱਸ ਬੁਸ ਵਧੀਆ ਇਹਨਾਂ ਦੀ ਠੀਕ ਹੈ ਵਧੀਆ ਹਾਂਜੀ ਜੀ ਠੀਕ ਏ ਰੇਟ ਚਾਹੀਦੀ ਆ ਹਾਂਜੀ ਠੀਕ ਹਾਂਜੀ ਹਾਂ ਜੀ ਕਾਹਨੂੰ ਹਾਂਜੀ ਹਾਂਜੀ ਤਾਂ ਹੀ ਅਸੀਂ ਤੁਹਾਨੂੰ ਫੋਨ ਕਰਿਆ ਜੇ ਆ ਜਾਂਗੇ ਦਫ਼ਤਰ ਹੀ ਆ ਜਾਂਗੇ ਜੀ ਓਕੇ ਓਕੇ ਸਰ ਓਕੇ